ਧਰਮ ਸਾਡੇ ਖੇਤਰ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਜਾਂ ਚੀਜ਼ਾਂ ਨਾਲ ਪ੍ਰਭਾਵਿਤ ਕਰਦਾ ਹੈ ਲਾਈਕ ਗੱਲਾਂ ਜਿਵੇਂ ਕਿ ਇਤਿਹਾਸ ਨਾਲ ਸੰਬੰਧਿਤ ਹੋ ਗਈਆਂ ਇਤਿਹਾਸ ਨਾਲ ਸੰਬੰਧਿਤ ਚੀਜ਼ਾਂ ਹੋ ਗਈਆਂ ਜਿਸ ਦੇ ਨਾਲ ਕਿ ਮਤਲਬ ਜਿਵੇਂ ਕਿ ਇਤਿਹਾਸ ਨਾਲ ਸੰਬੰਧਿਤ ਜਲ੍ਹਿਆਂਵਾਲਾ ਬਾਗ ਹੈ ਉਹ ਹੈ ਉੱਥੇ ਆ ਕੇ ਮਤਲਬ ਲੋਕ ਆਉਂਦੇ ਹਨ ਸੈਰ ਸਪਾਟੇ ਵਜੋਂ ਮਤਲਬ ਲੋਕ ਆਪਣੇ ਆਪ ਨੂੰ ਪ ਪ੍ਰਭਾ ਉਹ ਸੈਰ ਸਪਾਟਾ ਕਰਕੇ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਆਪਣਾ ਇੱਕ ਤਾਂ ਉਹ ਆਪਣੇ ਇੰਟਰਟੇਨਮੈਂਟ ਕਰਦੇ ਹਨ ਦੂਜੀ ਗੱਲ ਇਹ ਕਿ ਉਹ ਇਤਿਹਾਸਿਕ ਗੱਲਾਂ ਨੂੰ ਜਾਣਦੇ ਹਨ ਅਤੇ ਦੂਜਾ ਜ ਜੇ ਦੁਨੀਆ ਭਰ ਦੇ ਲੋਕ ਦੇਸ਼ ਭਰ ਦੇ ਲੋਕ ਜਿਹੜੇ ਜਿੱਥੇ ਆਉਂਦੇ ਹਨ ਉਹ ਅੰਮ੍ਰਿਤਸਰ ਦਾ ਇੱਕ ਮਸ਼ਹੂਰ ਸ਼੍ਰੀ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਦੇ ਨਾਮ ਵਜੋਂ ਹੀ ਅੰਮ੍ਰਿਤਸਰ ਨੂੰ ਜਾਣਿਆ ਜਾਂਦਾ ਹੈ ਜਿੱਥੋਂ ਕਿ ਦੇਸ਼ ਭਰ ਦੇ ਲੋਕ ਆਉਂਦੇ ਹਨ ਅਤੇ ਆ ਕੇ ਧਰਮ ਧਰਮ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਨੂੰ ਸਿੱਖਦੇ ਹਨ ਆਪਣੀ ਪ੍ਰਕਿਰਿਆ ਨੂੰ ਪੂਰਾ ਕਰਦੇ ਹਨ ਅਤੇ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਦੇ ਹਨ ਅਤੇ ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਦੇ ਨਾਲ ਹੀ ਸ਼ੀ ਅਮ ਸ਼੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸ਼ਹਿਰ ਨੂੰ ਜਾਣਿਆ ਜਾਂਦਾ ਹੈ ਥੈਂਕ ਯੂ